ਕੋਵਿਡ ਲੋਕਡਾਊਨ ਦੌਰਾਨ ਮੋਬਾਈਲ ਫੋਨ ਨੇ ਬੱਚਿਆਂ ਦੀ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ ਕਿਉਂਕਿ ਉਸ ਦੌਰਾਨ ਸਭ ਕੁਝ ਬੰਦ ਹੋ ਚੁੱਕਿਆ ਸੀਗਾ ਸਰਕਾਰਾਂ ਨੇ ਸਕੂਲਾਂ ਨੂੰ ਕੋਲਜਾਂ ਨੂੰ ਸਭ ਕੁਛ ਨੂੰ ਬੰਦ ਕਰ ਦਿੱਤਾ ਸੀ ਇਸ ਤਰ੍ਹਾਂ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੀ ਪਰ ਫਿਰ ਸਰਕਾਰ ਨੇ ਇੱਕ ਅਹਿਮ ਕਦਮ ਚੱਕਿਆ ਕਿ ਬੱਚਿਆਂ ਦੀ ਪੜ੍ਹਾਈ ਔਨਲਾਈਨ ਸ਼ੁਰੂ ਕੀਤੀ ਔਨਲਾਈਨ ਹੋਣ ਨਾਲ ਬੱਚੇ ਘਰ ਬੈਠੇ ਪੜ੍ਹਨ ਲੱਗ ਗਏ ਅਤੇ ਉਹਨਾਂ ਦੀਆਂ ਉਹਨਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਬਚ ਗਿਆ ਪਰ ਇਸ ਦਾ ਇੱਕ ਨੁਕਸਾਨ ਇਹ ਹੋਇਆ ਕਿ ਜੋ ਬੱਚੇ ਛੋਟੇ ਹਨ ਉਹਨਾਂ ਦੀ ਨਿਗ੍ਹਾ 'ਤੇ ਬਹੁਤ ਜ਼ਿਆਦਾ ਮੋਬਾਈਲ ਦੇਖਣ ਨਾਲ ਪ੍ਰਭਾਵ ਪੈਂਦਾ ਹੈ ਅਤੇ ਇੱਕ ਉਹ ਬੱਚਿਆਂ ਨੂੰ ਕੁਝ ਬੱਚੇ ਇੱਦਾਂ ਦੇ ਹਨ ਜਿਨ੍ਹਾਂ ਕੋਲ ਮੋਬਾਈਲ ਖਰੀਦਣ ਦੀ ਔਕਾਤ ਨਹੀਂ ਹੁੰਦੀ ਬੇਚਾਰੇ ਉਹ ਪੜ੍ਹਾਈ ਤੋਂ ਵਾਂਝੇ ਰਹਿ ਗਏ ਹਨ ਇਸ ਪਲਾਂ ਨਾਲ ਇਹ ਇਸ ਤਰ੍ਹਾਂ ਇਹ ਇਸ ਦੇ ਕੁਛ ਫਾਇਦੇ ਵੀ ਹੋਏ ਹਨ ਅਤੇ ਨੁਕਸਾਨ ਵੀ ਹੋਏ ਹਨ ਪਰ ਇਹ ਸਭ ਤੋਂ ਜ਼ਿਆਦਾ ਇਸ ਦੇ ਫਾਇਦੇ ਨੁਕਸਾਨ ਇਹ ਹਨ ਕਿ ਮਤਲਬ ਕਿ ਕੋਈ ਬੱਚਿਆਂ ਦੇ ਸਿਹਤ ਦੇ ਨਾਲ ਵੀ ਇਹ ਖਿਲਵਾੜ ਹੋਇਆ ਹੈ ਸਿਹਤ ਨਾਲ ਖਿਲਵਾੜ ਇੱਦਾਂ ਕਹਿ ਸਕਦੇ ਹਾਂ ਆਪਾਂ ਕਿ ਬੱਚੇ ਹਮੇਸ਼ਾ ਫੋਨ ਨਾਲ ਅਟੈਚ ਰਹਿਣ ਲੱਗ ਗਏ ਉਹਨਾਂ ਦਾ ਫੋਨ ਦੇ ਵਿੱਚ ਇੰਟਰਸਟ ਜ਼ਿਆਦਾ ਵੱਧ ਗਿਆ ਅਤੇ ਫੋਨ ਇੱਕ ਅਜਿਹੀ ਬਿਮਾਰੀ ਹੈ ਜੋ ਸਾਡੇ ਸਿਹਤ ਲਈ ਚੰਗੀ ਸਹੀ ਨਹੀਂ ਹੈ